ਮੈਂ ਸਕਰੈਚ ਤੋਂ ਬਹੁਤ ਕੁਛ ਬਣਾਇਆ ਹੈ ਜਿਵੇਂ ਕਿ ਘਰ ਵਿੱਚ ਤੁਹਾਡੇ ਫਾਲਤੂ ਚੀਜ਼ਾਂ ਤਾਂ ਮਿਲ ਹੀ ਜਾਂਦੀਆਂ ਹਨ ਜੋ ਤੁਸੀਂ ਸੁੱਟ ਦਿੰਦੇ ਹੋ ਜਿੱਦਾਂ ਪਾਣੀ ਦੀਆਂ ਬੋਤਲਾਂ ਅਖ਼ਬਾਰਾਂ ਫਾਲਤੂ ਕਾਗਜ਼ ਅਤੇ ਹੋਰ ਵੀ ਇਹੋ ਜਿਹੀਆਂ ਚੀਜ਼ਾਂ ਜਿਹਨਾਂ ਨੂੰ ਆਪਾਂ ਫਾਲਤੂ ਸਮਝ ਕੇ ਸੁੱਟ ਦਿੰਦੇ ਹਾਂ ਜਾਂ ਖ਼ਰਾਬ ਸਮਝ ਕੇ ਸੁੱਟ ਦਿੰਦੇ ਹਾਂ ਉਹਨਾਂ ਚੀਜ਼ਾਂ ਤੋਂ ਘਰ ਦੀ ਡੈਕੋਰੇਸ਼ਨ ਲਈ ਬਹੁਤ ਕੁਝ ਬਣ ਸਕਦਾ ਹੈ ਜਿਵੇਂ ਕਿ ਬੋਤਲਾਂ ਨਾਲ ਤੁਸੀਂ ਬਹੁਤ ਕੁਛ ਡੈਕੋਰੇਸ਼ਨ ਲਈ ਬਣਾ ਸਕਦੇ ਹੋ ਅਖ਼ਬਾਰਾਂ ਵੀ ਇਸ ਕੰਮ ਵਿੱਚ ਆਉਂਦੀਆਂ ਹਨ ਫਾਲਤੂ ਦੇ ਪੇਪਰ ਵੀ ਇਹਨਾਂ ਕੰਮਾਂ ਵਿੱਚ ਕੰਮ ਆਉਂਦੇ ਹਨ ਤੁਸੀਂ ਆਪਣੇ ਘਰ ਦੀ ਡੈਕੋਰੇਸ਼ਨ ਲਈ ਬਹੁਤ ਕੁਝ ਬਣਾ ਸਕਦੇ ਹੋ ਮੈਂ ਵੀ ਇਹਨਾਂ ਚੀਜ਼ਾਂ ਤੋਂ ਬਹੁਤ ਕੁਛ ਬਣਾਇਆ ਸੀ ਜਿਵੇਂ ਕਿ ਫਲਾਵਰ ਪੋਟ ਫੋਟੋ ਫਰੇਮ ਅਤੇ ਹੋਰ ਵੀ ਇਹੋ ਜਿਹੀਆਂ ਬਹੁਤ ਚੀਜ਼ਾਂ ਜੋ ਤਾਂ ਤੁਹਾਡੇ ਘਰ ਨੂੰ ਸੁੰਦਰ ਰੱਖਣ ਵਿੱਚ ਮਦਦ ਕਰਦੀਆਂ ਹਨ